ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਖੇਤੀਬਾੜੀ ਜਿਵੇੇਂ ਕਿ ਫਸਲ ਲਗਾ ਲਓ ਦੋ ਕਿਲੇ ਵਾਲੇ ਕਿਸਾਨ ਇਹ ਹਰੇਕ ਮੌਸਮ ਦੇ ਹਿਸਾਬ ਨਾਲ ਆਪਣੀਆਂ ਸਬਜ਼ੀਆਂ ਬੀਜਦੇ ਆ ਅਤੇ ਇਸ ਸਬਜ਼ੀਆਂ ਨੂੰ ਉਗਾ ਕੇ ਵਧੀਆ ਤਰੀਕੇ ਨਾਲ ਇਕੱਠੇ ਕਰਕੇ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਵਧੀਆ ਤਰੀਕੇ ਨਾਲ ਉਹਦੀ ਵਿਕਰੀ ਕਰਕੇ ਆਉਂਦੇ ਆ ਤਾਂ ਸਹੀ ਤਰੀਕੇ ਨਾਲ ਐਨ ਬਹੁਤ ਵਧੀਆ ਮਾਇਨੇ ਦੇ ਵਿੱਚ ਉਹਨਾਂ ਨੂੰ ਮੁਨਾਫਾ ਹੁੰਦਾ ਅਤੇ ਸਹੀ ਤਰੀਕੇ ਨਾਲ ਵਧੀਆ ਆਪਣਾ ਤੋਰਦੇ ਆ ਕੰਮ ਕਾਰ ਨੂੰ ਅੱਗੇ ਦੂਸਰਾ ਡੇਅਰੀ ਫਾਰਮ ਡੇਅਰੀ ਫਾਰਮ 'ਚ ਆਪਣਾ ਕਾਫੀ ਜ਼ਿਆਦਾ ਆਪਣਾ ਕੰਮ ਵਧਾਉਂਦੇ ਆ ਅੱਗੇ ਜਿਵੇਂ ਕਿ ਦੁੱਧ ਦਾ ਲਗਾ ਲਓ ਪੈਕੇਟਾਂ ਵਾਲੇ ਦੁੱਧ ਨਾਲ ਅਤੇ ਚੰਗਾ ਦੁੱਧ ਡੇਅਰੀ 'ਚ ਤਾਂ ਮਿਲਦਾ ਹੈ ਅਤੇ ਕਾਫੀ ਜ਼ਿਆਦਾ ਲੋਕਾਂ ਦੇ ਸਰੀਰ ਲਈ ਸਹੀ ਰਹਿੰਦਾ ਡੇਅਰੀ ਵਾਲਾ ਦੁੱਧ ਦੂਸਰਾ ਸਿੰਚਾਈ ਲਗਾ ਲਓ ਸਿੰਚਾਈ ਆਪਣਾ ਜਿਵੇਂ ਕਿ ਸਤਲੁਜ ਦਰਿਆ ਹੋ ਗਿਆ ਦਰਿਆਵਾਂ ਦਾ ਪਾਣੀ ਬਹੁਤ ਸਾਫ ਆ ਵਧੀਆ ਤਰੀਕੇ ਨਾਲ ਪਾਣੀ ਆਉਂਦਾ ਜਿਹੜਾ ਆਮ ਗੰਦਾ ਪਾਣੀ ਆਉਂਦਾ ਉਹ ਖੇਤਾਂ ਵੱਲੇ ਨੂੰ ਤੋਰ ਦਿੰਦੇ ਆ ਤਾਂ ਪਾਣੀ ਜੋ ਕਿ ਖੇਤਾਂ ਨੂੰ ਖਾਦ ਦੇ ਤੌਰ 'ਤੇ ਵਧੀਆ ਤਰੀਕੇ ਨਾਲ ਅੱਗੇ ਫਸਲ ਵਧੇ ਅਤੇ ਉਸ ਤੋਂ ਬਾਅਦ ਫੈਕਟਰੀਆਂ ਲਗਾ ਲਓ ਆਪਣੀਆਂ ਫੈਕਟਰੀ ਜਿਵੇਂ ਕਿ ਇੱਥੇ ਰੋਪੜ ਜ਼ਿਲ੍ਹੇ ਦੇ ਵਿੱਚ ਅੰਬੂਜਾ ਫੈਕਟਰੀ ਹੋ ਗਈ ਸਵਰਾਜ ਫੈਕਟਰੀ ਹੋ ਗਈ ਰਣਬੈਕਸੀ ਫੈਕਟਰੀ ਹੋ ਗਈ ਜਿਸ ਨਾਲ ਲੋ ਕਈ ਲੋਕਾਂ ਦਾ ਘਰ ਚੱਲਦਾ ਬਹੁਤ ਵਧੀਆ ਤਰੀਕੇ ਨਾਲ ਰੁਜ਼ਗਾਰ ਚੱਲ ਰਿਹਾ